ਹੈਲੋ ਹਾਂਜੀ ਵੀਰ ਜੀ ਕਿਵੇਂ ਹੋ ਵਧੀਆ ਵਧੀਆ ਵਧੀਆ ਹੋਰ ਸੁੱਖ ਸਾਂਦਿ ਹੈ ਜੀ ਕਿਵੇਂ ਲੰਘਦਾ ਟਾਈਮ ਅੱਛਾ ਜਵਾਕ ਤੁਹਾਡੇ ਵੀ ਬਾਹਰ ਚਲੇ ਗਏ ਉਹ ਸਾਡੇ ਵਾਲੇ ਤਾਂ ਆਪ ਜੀ ਦੇਖੋ ਹੁਣ ਐਮ ਏ ਬੀ ਐਡਾਂ ਕਰੀਆਂ ਨੇ ਐਮ ਏ ਇੰਗਲਿਸ਼ ਕਰੀ ਬੈਠੇ ਨੇ ਪਰ ਉਹ ਕਹਿੰਦੇ ਜੀ ਰੁਜ਼ਗਾਰ ਨਹੀਂ ਮਿਲਦਾ ਕਰੀਏ ਕੀ ਇੱਥੇ ਰਹਿ ਕੇ ਬੇਰੁਜ਼ਗਾਰੀ ਦਾ ਵੀ ਬਹੁਤ ਜ਼ਿਆਦਾ ਹੋ ਗਿਆ ਜੀ ਕੰਮ ਹੋਰ ਜੀ ਹੁਣ ਰੀਸੋ ਰੀਸ ਵੀ ਹੋ ਗਿਆ ਕੰਮ ਕੁਝ ਭਾਈ ਰੁਜ਼ਗਾਰ ਵੀ ਹੈ ਨਹੀਂ ਹੈ ਨਾ ਹੁਣ ਕਰੀਏ ਵੀ ਕੀ ਬਜ਼ੁਰਗਾਂ ਨੂੰ ਸਾਨੂੰ ਵੀ ਇਹੀ ਫਿਕਰ ਹੈ ਜੀ ਅਸੀਂ ਵੀ ਹੁਣ ਦੇਖੋ ਪੈਨਸ਼ਨਏਬਲ ਹੋਏ ਹੋਏ ਐਂ ਵੀ ਹੁਣ ਤਾਂ ਜਵਾਕਾਂ ਨਾਲ ਪੈਨਸ਼ਨ ਪੁਨਸ਼ਨ ਲੈਣ ਵਗ ਜਾਂਦੇ ਇਹ ਕਹਿੰਦੇ ਨੇ ਅਸੀਂ ਬਾਹਰ ਜਾਣਾ ਜਾਂ ਤਾਂ ਬਾਪੂ ਸਾਨੂੰ ਰੁਜ਼ਗਾਰ ਦਵਾ ਦੇ ਇੱਥੇ ਨਹੀਂ ਫਿਰ ਅਸੀਂ ਤਾਂ ਬਾਹਰ ਜਾਣਾ ਸਾਨੂੰ ਵੀ ਇਹੀ ਫਿਕਰ ਆ ਵੀ ਫਿਰ ਅਸੀਂ ਇਕੱਲੇ ਰਹਿ ਜਾਵਾਂਗੇ ਸਾਡੇ ਕੋਲ ਕੌਣ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੀ ਪੜ੍ਹਾਈ ਦੇ ਹਿਸਾਬ ਨਾਲ ਨਹੀਂ ਨਾ ਮਿਲਦੀ ਊਂ ਛੋਟੀ ਮੋਟੀ ਤਾਂ ਮਿਲਜੂ ਉਹ ਵੀ ਸਾਡੇ ਬੱਚੇ ਵੀ ਇਹੀ ਗੱਲ ਕਰਦੇ ਨੇ ਕਹਿੰਦੇ ਜਿਸ ਹਿਸਾਬ ਨਾਲ ਮੇਰੇ ਕੋਲ ਡਿਗਰੀਆਂ ਨੇ ਉਸ ਹਿਸਾਬ ਨਾਲ ਨਹੀਂ ਨਾ ਮਿਲ ਰਹੀ ਮੈਨੂੰ ਉਹੀ ਗੱਲ ਹੈ ਜੀ ਹੁਣ ਤਾਂ ਬਸ ਆਪਾਂ ਤਾਂ ਬੇਵੱਸ ਹੋਏ ਮੈਂ ਦੇਖੋ ਜੀ ਮੈਂ ਕਿਹਾ ਜਿਵੇਂ ਤੁਹਾਡਾ ਚਿੱਤ ਮੰਨਦਾ ਭਾਈ ਉਵੇਂ ਕਰ ਲਉ ਤੁਹਾਨੂੰ ਰੁਜ਼ਗਾਰ ਮਿਲਣਾ ਚਾਹੀਦਾ ਨਹੀਂ ਜੀ ਆ ਜਿਓ ਸ਼ਰਮਾ ਜੀ ਕਦੇ ਫਿਰ ਬਹਿ ਕੇ ਗੱਪਾਂ ਲੜਾਵਾਂਗੇ

ਹਾਂਜੀ ਹਾਂਜੀ ਬਸ ਫੋਨ ਕਰਕੇ ਆਉ ਜੀ ਕਿਤੇ ਮੈਂ ਨਾ ਦਵਾਈ ਲੈਣ ਗਿਆ ਹੋਵਾਂ ਕਿਤੇ ਠੀਕ ਹੈ ਜੀ ਠੀਕ ਹੈ ਓਕੇ ਜੀ ਓ ਸਤਿ ਸ਼੍ਰੀ ਅਕਾਲ ਜੀ